ਹੈਲੋ ਹਾਂਜੀ ਹਾਂਜੀ ਹਾਂਜੀ ਵਿਸ਼ਾਲ ਹਾਂਜੀ ਅੱਛਾ ਅੱਛਾ ਠੀਕ ਹੈ ਅਤੇ ਇਹਦੇ ਵਾਸਤੇ ਆਪਾਂ ਨੂੰ ਕੀ ਕੁਝ ਚਾਹੀਦਾ ਏ ਥੋੜ੍ਹਾ ਜਿਹਾ ਦੱਸੋਗੇ ਹਾਂਜੀ ਹਾਂਜੀ ਅੱਛਾ ਅੱਛਾ ਹਾਂਜੀ ਹਾਂਜੀ ਠੀਕ ਹੈ ਅਤੇ ਮਤਲਬ ਇਹਦੇ ਵਿੱਚ ਆਪਾਂ ਨੂੰ ਖਰਚਾ ਮਤਲਬ ਘੱਟ ਪਏਗਾ ਕਿ ਬਿਲਕੁਲ ਫਰੀ ਹੋਏਗੀ ਇਹ ਸਕੀਮ ਜਿਹੜੀ ਤੁਸੀਂ ਦੱਸਦੇ ਹੋ ਅੱਛਾ ਅੱਛਾ ਇਸ ਤੋਂ ਇਲਾਵਾ ਵੀ ਕੋਈ ਹੋਰ ਹੈਗੀ ਹੈ ਸਕਾਲਰਸ਼ਿਪ ਸਕੀਮ ਕਿ ਇਹੀ ਹੈ ਹਮ ਹਮ ਚਲੋ ਠੀਕ ਹੈ ਜੀ ਮੈਂ ਫਿਰ ਆਪਣੇ ਜਿੰਨੇ ਵੀ ਹੈਗੇ ਨੇ ਕਾਗਜ਼ ਪੱਤਰ ਉਹ ਤਿਆਰ ਰੱਖਦੀ ਐਂ ਫਿਰ ਆਪਾਂ ਉਹਨੂੰ ਇਸ ਤਰ੍ਹਾਂ ਕਰ ਲਾਂਗੇ ਤੁਸੀਂ ਮੈਨੂੰ ਦੱਸ ਦਿਓ ਇੱਕ ਵਾਰ ਜਦੋਂ ਵੀ ਕਰਨਾ ਭਰਨਾ ਹੋਇਆ ਠੀਕ ਹੈ ਠੀਕ ਹੈ ਜੀ ਓਕੇ ਜੀ ਧੰਨਵਾਦ ਬਾਏ